ਮਾਨਸਾ ਜ਼ਿਲ੍ਹੇ ਦੇ ਵਿੱਚ ਸ਼ਿਲਪਕਾਰੀ ਦੇ ਕਈ ਨਮੂਨੇ ਅੱਜ ਵੀ ਮੌਜੂਦ ਹਨ ਜਿਸ ਦੇ ਵਿੱਚ ਬੜੀਆਂ ਪੁਰਾਤਨ ਬਿਲਡਿੰਗਾਂ ਜਿਵੇਂ ਕਿ ਪੁਲਾੜਾ ਸਾਹਿਬ ਇੱਕ ਬਹੁਤ ਹੀ ਪੁਰਾਣਾ ਸਥਾਨ ਹੈ ਜਿਸ ਦੇ ਲੋਕਾਂ ਨੂੰ ਜਾਣਕਾਰੀ ਦੇ ਵਿੱਚ ਪਤਾ ਲੱਗਦਾ ਹੈ ਕਿ ਪਾਂਡਵਾਂ ਦੇ ਸਮੇਂ ਦੇ ਵਿੱਚ ਪੰਜੇ ਪਾਂਡਵ ਦਰੋਪਤੀ ਸਹਿਤ ਉੱਥੇ ਆਏ ਉੱਥੇ ਵੀ ਕੁਛ ਪੁਰਾਣੀਆਂ ਬਿਲਡਿੰਗਾਂ ਦੇ ਨਿਸ਼ਾਨ ਅੱਜ ਵੀ ਮੌਜੂਦ ਹਨ ਉਸੇ ਤਰ੍ਹਾਂ ਹੀ ਜੇਕਰ ਆਪਾਂ ਭਿੱਖੀ ਦੇ ਵਿੱਚ ਥਾਣਾ ਸਦਰ ਇੱਕ ਪੁਰਾਣਾ ਕਿਲ੍ਹਾ ਹੈ ਜੋ ਕਿ ਭਿੱਖੀ ਦੇ ਰਾਜਾ ਭਿੱਖਾ ਦਾ ਇਹ ਕਿਲ੍ਹਾ ਹੁੰਦਾ ਸੀ ਅੱਜ ਪੂਰੀ ਬਿਲਡਿੰਗ ਉੱਥੇ ਮੌਜੂਦ ਹੈ ਅਤੇ ਠਾਣੇ ਦਾ ਸਾਰਾ ਕੰਮਕਾਜ ਉਸਦੇ ਵਿੱਚ ਹੀ ਹੁੰਦਾ ਹੈ ਇਸ ਤੋਂ ਬਾਅਦ ਲੱਕੜੀ ਦਾ ਭਿਖੀ ਦੇ ਵਿੱਚ ਇੱਕ ਖਟੀਕ ਸਮਾਜ ਕੰਮ ਕਰਦਾ ਹੈ ਉਹਨਾਂ ਦੇ ਕੋਲ ਅਕਸਰ ਹੀ ਬਹੁਤ ਪੁਰਾਣੇ ਲਕੜੀ ਦੇ ਸ਼ਿਪਲਕਾਰਾਂ ਦੁਆਰਾ ਬਣਾਈਆਂ ਹੋਈਆਂ ਜੋੜੀਆਂ ਅਤੇ ਦਰਵਾਜੇ ਦੇਖਣ ਨੂੰ ਮਿਲਦੇ ਹਨ ਜਿਸ ਦੇ ਉੱਪਰ ਪਿੱਤਲ ਦੇ ਚਿੱਤਰਕਾਰੀ ਕੀਤੀ ਹੋਈ ਹੁੰਦੀ ਹੈ ਇਸ ਤੋਂ ਇਲਾਵਾ ਮਾਨਸਾ ਜ਼ਿਲ੍ਹੇ ਦੇ ਦੇ ਵਿੱਚ ਇੱਕ ਰਾਖੀ ਕਲਾ ਕੇਂਦਰ ਮਸ਼ਹੂਰ ਹੈ ਜਿਸ ਨੇ ਚੱਪਲਾਂ ਫਾਲਤੂ ਚੱਪਲਾਂ ਦੇ ਤੋਂ ਅਲੱਗ ਅਲੱਗ ਕਿਸਮ ਦੇ ਖਿਡੌਣੇ ਅਤੇ ਹੋਰ ਬਹੁਤ ਕੁਛ ਬਣਾਇਆ ਹੈ ਉਸਦੀ ਕਲਾ ਕਿਰਤੀ ਵੀ ਦੇਖਣ ਯੋਗ ਹੈ